ਹੈਲੋ ਮੇਰਾ ਨਾਂ ਦਕਸ਼ਜੋਤ ਸਿੰਘ ਹੈ ਮੈਂ ਆਪਣੀ ਇੱਕ ਮਨਪਸੰਦ ਗੇਮ ਬਾਰੇ ਦੱਸਣਾ ਚਾਹੁੰਦਾ ਹਾਂ ਕਿ ਮੇਰੀ ਮਨਪਸੰਦ ਗੇਮ ਫੁੱਟਬੋਲ ਹੈ ਫੁੱਟਬੋਲ ਗੇਮ ਬਹੁਤ ਹੀ ਜ਼ਿਆਦਾ ਵਧੀਆ ਗੇਮ ਹੈ ਜਿਸ ਨਾਲ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਬਿਮਾਰੀਆਂ ਤੋਂ ਸੌ ਗੁਣਾ ਦੂਰ ਰਹਿੰਦਾ ਹੈ ਸਾਡਾ ਸਰੀਰ ਅਤੇ ਫੁੱਟਬੋਲ ਗੇਮ ਨਾਲ ਸਾਨੂੰ ਲਾਭ ਅਤੇ ਫਾਇਦੇ ਬਹੁਤ ਹੀ ਜ਼ਿਆਦਾ ਹੁੰਦੇ ਹਨ ਫੁੱਟਬੋਲ ਗੇਮ ਨਾਲ ਸਾਡੀ ਰੇਸ ਬਹੁਤ ਹੀ ਜ਼ਿਆਦਾ ਵੱਧ ਜਾਂਦੀ ਹੈ ਅਤੇ ਉਸ ਨਾਲ ਸਾਡੇ ਸਰੀਰ ਜਮ੍ਹਾਂ ਪਤਲਾ ਰਹਿੰਦਾ ਹੈ ਅਤੇ ਬਿਮਾਰੀਆਂ ਤੋਂ ਵੀ ਦੂਰ ਰਹਿੰਦਾ ਹੈ ਕਿਉਂਕਿ ਸਰੀਰ ਵਿੱਚ ਵਜਨ ਵਧੇਗਾ ਤਾਂ ਬਿਮਾਰੀਆਂ ਹੋਣਗੀਆਂ ਇਸ ਲਈ ਫੁੱਟਬੋਲ ਗੇਮ ਜਦੋਂ ਮੈਂ ਫਸਟ ਕਲਾਸ ਵਿੱਚ ਸੀ ਉਹ ਤੋਂ ਤੀਜੀ ਕਲਾਸ ਵਿੱਚ ਹੁਣ ਸਾਰੀ ਜੋ ਕਿ ਮੇਰੇ ਸਕੂਲ ਵਿੱਚ ਇੱਕ ਸਰ ਸੀ ਉਹ ਫੁੱਟਬੋਲ ਦੇ ਸਰ ਸਨ ਉਸ ਨੇ ਤੀਜੀ ਕਲਾਸ ਤੋਂ ਲੈ ਕੇ ਪਲੱਸ ਟੂ ਕਲਾਸ ਤੱਕ ਮੈਨੂੰ ਫੁੱਟਬਾਲ ਦੇ ਵਿੱਚ ਬਹੁਤ ਹੀ ਜ਼ਿਆਦਾ ਸਿੱਖਿਆ ਦਿੱਤੀ ਅਤੇ ਖਿਡਾਇਆ ਅਤੇ ਕਈ ਸਾਰੇ ਟੂਰਨਾਮੈਂਟ ਵੀ ਜਿਤਾਏ ਜਿਸ ਨਾਲ ਮੈਨੂੰ ਬਹੁਤ ਹੀ ਜ਼ਿਆਦਾ ਫਾਇਦਾ ਹੋਇਆ ਇੱਕ ਤਾਂ ਮੈਂ ਪਹਿਲ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਫੁੱਟਬਾਲ ਦੇ ਖੇਤਰ ਵਿੱਚ ਰਿਹਾ ਉਸ ਨਾਲ ਮੈਂ ਨਸ਼ਿਆਂ ਤੋਂ ਵੀ ਦੂਰ ਰਿਹਾ ਅਤੇ ਉੱਧਰ ਨੂੰ ਮੇਰਾ ਧਿਆਨ ਨਹੀਂ ਗਿਆ ਅਤੇ ਮੈਂ ਹੋਰ ਆਮ ਗੱਲਾਂ ਤੋਂ ਵੀ ਜ਼ਿਆਦਾ ਦੂਰ ਰਿਹਾ ਇਸ ਨਾਲ ਮੈਂ ਕਈ ਥਾਵਾਂ 'ਤੇ ਜ਼ਿਲ੍ਹਾ ਪੰਜਾਬ ਤਕਸੀਲ ਜਿੱਤੇ ਜੂਨ ਜਿੱਤੇ ਫੁੱਟਬੋਲ ਦੇ ਖੇਤਰ ਵਿੱਚ ਅਤੇ ਮੈਨੂੰ ਟਰੋਫੀ ਅਤੇ ਅਤੇ ਇਨਾਮ ਅਤੇ ਪੈਸੇ ਵਜੋਂ ਵੀ ਦਿੱਤੇ ਗਏ ਤਾਂ ਕਰਕੇ ਮੈਂ ਫੁੱਟਬੋਲ ਗੇਮ ਚੁਣੀ ਹੈ ਅਤੇ ਇਸ ਨਾਲ ਗੇਮ ਨਾਲ ਸਾਨੂੰ ਸਰਕਾਰੀ ਨੌਕਰੀ ਵਿੱਚ ਬਹੁਤ ਹੀ ਜ਼ਿਆਦਾ ਫਾਇਦਾ ਹੁੰਦਾ ਹੈ ਅਤੇ ਸਾਨੂੰ ਸਰਕਾਰ ਸਰਕਾਰੀ ਨੌਕਰੀ ਛੇਤੀ ਦਿੰਦੀ ਹੈ ਗੇਮ ਦੇ ਖੇਤਰ ਵਿੱਚ ਇਸ ਲਈ ਮੈਂ ਆਪਣੀ ਫੁੱਟਬੋਲ ਗੇਮ ਚੁਣੀ